ਮੇਰੇ ਵੱਲੋਂ ਬਾਗਵਾਨੀ ਘਰ ਦੇ ਵਿਹੜੇ ਵਿੱਚ ਹੀ ਕੀਤੀ ਜਾਂਦੀ ਹੈ ਮੇਰੇ ਵੱਲੋਂ ਆਪਣੇ ਘਰ ਦੇ ਇੱਕ ਕੋਨੇ ਵਿੱਚ ਇਸ ਲਈ ਕੱਚੀ ਥਾਂ ਰੱਖੀ ਗਈ ਹੈ ਜਿਸ ਵਿੱਚ ਮੇਰੇ ਵੱਲੋਂ ਬਾਗਵਾਨੀ ਕੀਤੀ ਜਾਂਦੀ ਹੈ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੇਰੇ ਵੱਲੋਂ ਕੀਤੀ ਜਾਂਦੀ ਬਾਗਬਾਨੀ ਵਿੱਚ ਆਮ ਤੌਰ 'ਤੇ ਔਰਗੈਨਿਕ ਬਾਗਵਾਨੀ ਹੀ ਕੀਤੀ ਜਾਵੇ ਮੈਂ ਅੱਜ ਦੇ ਸਮੇਂ ਵਿੱਚ ਖਾਦਾਂ ਅਤੇੇ ਰੇਹਾਂ ਸਪਰੇਆਂ ਤੋਂ ਪਰਹੇਜ਼ ਕਰਦਾ ਹਾਂ ਮੇਰੇ ਵੱਲੋਂ ਵਿਹੜੇ ਵਿੱਚ ਘਰ ਦੀ ਦੇਸੀ ਤਰੀਕੇ ਨਾਲ ਤਿਆਰ ਕੀਤੀ ਹੋਈ ਰੂੜੀ ਖਾਦ ਦਾ ਇਸਤੇਮਾਲ ਕੀਤਾ ਜਾਂਦਾ ਹੈ ਮੇਰੇ ਵੱਲੋਂ ਕੁਛ ਫਲਦਾਰ ਬੂਟੇ ਵੀ ਲਗਾਏ ਗਏ ਹਨ ਜਿਨ੍ਹਾਂ ਵਿੱਚ ਅੰਬ ਅਮਰੂਦ ਜਾਮਣ ਇਹ ਮੁੱਖ ਤੌਰ 'ਤੇ ਸ਼ਾਮਿਲ ਹਨ ਇਸ ਤੋਂ ਇਲਾਵਾ ਮੇਰੇ ਵੱਲੋਂ ਸਬਜ਼ੀਆਂ ਦੀ ਵੀ ਖੇਤੀ ਕੀਤੀ ਜਾਂਦੀ ਹੈ ਮੌਜੂਦਾ ਸਮੇਂ ਵਿੱਚ ਗਰਮੀ ਦਾ ਸੀਜ਼ਨ ਹੋਣ ਕਰਕੇ ਮੇਰੇ ਵੱਲੋਂ ਗਰਮੀ ਦੀਆਂ ਲਗਭਗ ਸਾਰੀਆਂ ਹੀ ਸਬਜ਼ੀਆਂ ਆਪਣੇ ਘਰ ਦੇ ਵਿਹੜੇ ਵਿੱਚ ਲਗਾਈਆਂ ਗਈਆਂ ਹਨ ਇਹਨਾਂ ਵਿੱਚ ਭਿੰਡੀ ਤੋਰੀ ਘੀਆ ਕੱਦੂ ਹਲਵਾ ਕੱਦੂ ਅਤੇ ਸ਼ਿਮਲਾ ਮਿਰਚ ਆਦਿ ਦੀ ਬਾਗਵਾਨੀ ਮੇਰੇ ਵੱਲੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਮੈਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਕੁਛ ਨਾ ਕੁਛ ਨਵੇਂ ਪੌਦੇ ਨਰਸਰੀ ਤੋਂ ਲਿਆ ਕੇ ਉਹਨਾਂ ਵਿੱਚ ਲਗਾਉਂਦਾ ਰਹਾਂ ਕੁਛ ਦਿਨ ਪਹਿਲਾਂ ਹੀ ਮੇਰੇ ਵੱਲੋਂ ਕੜੀ ਪੱਤੇ ਦਾ ਇੱਕ ਬੂਟਾ ਲਗਾਇਆ ਗਿਆ ਹੈ ਇਹ ਸਬਜ਼ੀ ਵਿੱਚ ਤੜਕੇ ਇਸ ਦੇ ਪੱਤੇ ਸਬਜ਼ੀ ਵਿੱਚ ਤੁੜਕੇ ਲਈ ਇਸਤੇਮਾਲ ਹੁੰਦੇ ਹਨ ਇਹ ਕਲੈਸਟਰੋਲ ਆਦਿ ਘੱਟ ਕਰਨ ਵਿੱਚ ਵੀ ਕਾਫੀ ਮਦਦ ਕਰਦਾ ਹੈ ਅਤੇ ਇਹ ਬੂਟਾ ਕਾਫੀ ਗੁਣਾਂ ਨਾਲ ਭਰਪੂਰ ਹੈ ਇਸ ਤੋਂ ਇਲਾਵਾ ਇੱਕ ਸੁਹੰਜਣੇ ਦਾ ਬੂਟਾ ਵੀ ਕੁਛ ਦਿਨ ਪਹਿਲਾਂ ਹੀ ਮੇਰੇ ਅਲ ਵੱਲੋਂ ਲਗਾਇਆ ਗਿਆ ਹੈ ਮੈਂ ਇਸ ਬਾਰੇ ਪੜ੍ਹਿਆ ਸੀ ਕਿ ਇਹ ਇਸ ਦੀ ਦਵਾਈ ਕਾਫੀ ਰੋਗਾਂ ਵਿੱਚ ਇਸਤੇਮਾਲ ਹੁੰਦੀ ਹੈ ਅਤੇ ਇਸ ਦੇ ਪੱਤੇ ਬਹੁਤ ਹੀ ਮਤਲਬ ਗੁਣਾਂ ਨਾਲ ਭਰਪੂਰ ਹੁੰਦੇ ਹਨ